ਪੰਜਾਬ ਵਿੱਚ ਸਿਆਸੀ ਪ੍ਰਣਾਲੀ ਅਤੇ ਅੰਤਰ ਪ੍ਰਤੀ ਮੁੱਦਿਆਂ ਦੇ ਕੰਮ ਕਰਦੇ ਹਨ ਜਿਵੇਂ ਕਿ ਕਿਸੇ ਨੇ ਵਿਦੇਸ਼ ਦੇਸ਼ ਵਿਦੇਸ਼ ਤੋਂ ਕੋਈ ਚੀ ਮੰਗਵਾਉਣੀ ਹੋਵੇ ਜਿੱਦਾਂ ਕੋਈ ਵੀ ਕਹਿ ਸਕਦੇ ਆਪਾਂ ਵੀ ਗੱਡੀ ਐਕਸਪੋਰਟ ਕਰਵਾਉਣੀ ਹੋਵੇ ਹੈ ਨਾ ਤਾਂ ਉਹਦੇ 'ਚੋਂ ਉਹਦਾ ਮਸਲੇ ਦੇ ਹੱਲ ਕਰਨ ਦੇ ਵਿੱਚ ਕਿਤੇ ਕੋਈ ਫ਼ਸ ਜੇ ਕੋਈ ਵੱਡੀ ਚੀਜ਼ ਮੰਗਵਾਈ ਹੈ ਅਤੇ ਉਹਦੇ ਮਸਲੇ 'ਚ ਕੋਈ ਰੁਕਾਵਟ ਆ ਜਾਂਦੀ ਆ ਤਾਂ ਉਹਨੂੰ ਸੁਲਝਾਉਣ ਦੇ ਵਿੱਚ ਉਹ ਥੋੜ੍ਹੀ ਮਦਦ ਕਰਦੇ ਆ ਹਾਂ ਜੀ ਅਤੇ ਜਿਵੇਂ ਕਿਤੇ ਵੀ ਕੋਈ ਕੋਈ ਹੋਵੇ ਜਿਵੇ ਆ ਪਿੱਛੇ ਜੇ ਕਨੇਡਾ ਦੇ ਵਿੱਚ ਚੱਲਿਆ ਸੀ ਵੀ ਉਨ੍ਹਾਂ ਨੇ ਤਿੰਨ ਚਾਰ ਜਿਹੜੇ ਹੈਗੇ ਪੰਜਾਬ ਸਿੱਖ ਦੇ ਉਹ ਮਾ ਮਾਰਿਆ ਗਿਆ ਉਹਦੇ ਵਿੱਚ ਉਨ੍ਹਾਂ ਦਾ ਥੋੜ੍ਹਾ ਜਿਹਾ ਲੱਗਦਾ ਸੀ ਵੀ ਉਨ੍ਹਾਂ ਨੂੰ ਵੀ ਜਿਵੇਂ ਮਾਹੌਲ ਖ਼ਰਾਬ ਹੋਇਆ ਵਾ ਪਰ ਇੱਦਾਂ ਉਹ ਜਿਹੜੇ ਅਤੇ ਦੇਸ਼ ਦੀ ਪਾਰਟੀ ਬੈਠੀ ਹੁੰਦੀ ਅਤੇ ਅੰਤਰਰਾਸ਼ਟਰੀ ਪ੍ਰਣਾਲੀ ਜਿਹੜੀ ਉਹ ਉਨ੍ਹਾਂ ਨੂੰ ਇਹ ਜਿਹੇ ਕੰਮ ਸੁਲਝਾਉਣ ਦੇ ਵਿੱਚ ਕੰਮ ਆਉਂਦੀ ਹੈ ਅਤੇ ਉਨ੍ਹਾਂ ਦੀ ਮਦਦ ਕਰਦੀ ਹੈ ਵੀ ਨਹੀਂ ਸਭ ਭਾਈਚਾਰਾ ਸਾਂਝਾ ਬਣਾਈ ਰੱਖਦੀ ਹੈ ਜਿਵੇਂ ਕੋਈ ਵੀ ਕੰਮ ਹੋ ਜਾਂਦਾ ਕਿਤੇ ਵੀ ਕੋਈ ਕ ਗੱਲ ਦੀ ਉਨ੍ਹਾਂ ਦੀ ਆਪਸ ਦੇ ਵਿੱਚ ਕਿਤੇ ਦੁਸ਼ਮਣੀ ਜਿਹੀ ਹੋਜੇ ਤਾਂ ਉਹ ਪ੍ਰਣਾਲੀ ਜਿਹੜੀ ਹੁੰਦੀ ਸਾਂਝੀ ਪੈ ਇਕੱਠੇ ਬਹਿ ਜਾਂਦੇ ਗਰੁੱਪ ਉੱਧਰ ਦੂਜੀ ਓਪੋਜਿਟ ਸਾਈਡ ਤੋਂ ਵੀ ਪਾਰਟੀ ਆ ਜਾਂਦੀ ਹੈ ਵੀ ਸਡ ਸਾਡੇ ਉੱਤੇ ਪ੍ਰਣਾਲੀ ਬੈਠੀ ਹੁੰਦੀ ਬਹਿ ਕੇ ਦੋਵੇਂ ਆਪਸ ਦੇ ਵਿੱਚ ਸਾਂਝੀ ਗੱਲਬਾਤ ਕਰਦੇ ਆ ਵੀ ਕੀ ਹਿਸਾਬ ਹੈਗਾ ਫਿਰ ਉਹਨੂੰ ਨਿਪਟਾ ਨਿਪਟਾਉਣ ਦੀ ਕੋਸ਼ਿਸ਼ ਕਰਦੇ ਵੀ ਸਾਂਝ ਬਣਾਈ ਰੱਖੇ ਐਵੇਂ ਲੋਕਾਂ ਦੇ ਵਿੱਚ ਇੰਨਾ ਦੁਨੀਆ ਦਾ ਮਾਹੌਲ ਖ਼ਰਾਬ ਨਹੀਂ ਕਰਾਉਣਾ ਚਾਹੁੰਦੇ ਵੀ ਏਵੇਂ ਮਾਹੌਲ ਖ਼ਰਾਬ ਹੋਉਗਾ ਆਵਾਜਾਈ ਵੀ ਉੱਧਰ ਅਤੇ ਓਵੇਂ ਜਿਹੜੇ ਕੰਮ ਹੁੰਦੇ ਬਾਅਦ 'ਚੋਂ ਦੇਸ਼ ਵਿਦੇਸ਼ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਸਾਰੇ ਵਪਾਰਾਂ ਦਾ ਕੰਮ ਚੱਲਣ ਦਾ ਹੁੰਦਾ ਆਪਸ ਦੇ ਵਿੱਚ ਕਈ ਸਮਾਨ ਇੱਧਰੋ ਆਉਂਦੇ ਕਈ ਸਮਾਨ ਉੱਧਰੋਂ ਜਾਂਦੇ ਉਹ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਉਨ੍ਹਾਂ ਦੇ ਕੰਮਾਂ ਵਿੱਚ ਵੀ ਐਵੇਂ ਇਹੋ ਜਿਹੇ ਕੰਮ ਹੋਣਗੇ ਅਤੇ ਐਵੇਂ ਰੁਕਾਵਟ ਆਉਗੀ ਉਹ ਚੁੱਪ ਕਰ ਕੇ ਕੋਈ ਇਹੋ ਜਿਹੇ ਅਤੇ ਉਨ੍ਹਾਂ ਨੂੰ ਸਾਂਝਾ ਬਿਠਾ ਕੇ ਵੱਡੇ ਤੋਂ ਵੱਡੇ ਜਿਹੜੇ ਬੈਠੇ ਹੁੰਦੇ ਆ ਐੱਮ ਪੀ ਐੱਮ ਐੱਲ ਏ ਵਰਗੇ ਹੁੰਦੇ ਜਿਹੜੇ ਵੱਡੇ ਮੰਤਰੀ ਹੁੰਦੇ ਵਿਭਾਗ ਰਾਜ ਸਭਾ ਦੇ ਉਹ ਇਕੱਠੇ ਬਹਿ ਜਾਂਦੇ ਹੈ ਅਤੇ ਉਨ੍ਹਾਂ ਨੂੰ ਇਕੱਠੇ ਬਹਿ ਕੇ ਸਾਂਝੀ ਅਤੇ ਸੁਝਾਅ ਸੁਝਾਅ ਕਰ ਦਿੰਦੇ ਇਹੋ ਕੰਮ ਕਰਦੇ ਬੜਾ ਵੱਡਾ ਸਹਿਯੋਗ ਹੈਗਾ ਇਨ੍ਹਾਂ ਦਾ ਥੈਂਕ ਯੂ